ਹੈਲੋ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਵਿਗੀ ਤੋਂ ਬੋਲਦੇ ਪਏ ਜੀ ਹਾਂਜੀ ਭਾਈ ਭਾਅ ਜੀ ਮੈਂ ਅਤੇ ਮੇਰਾ ਪਰਿਵਾਰ ਤੁਹਾਡੇ ਇੱਥੇ ਆਉਣਾ ਜੀ ਰੈਸਟੋਰੈਂਟ 'ਚ ਖਾਣਾ ਖਾਣ ਵਾਸਤੇ ਮੈਂ ਜਾਣਨਾ ਚਾਹੁੰਦਾ ਸੀਗਾ ਕਿ ਭਾਅ ਜੀ ਤੁਹਾਡੇ 'ਚ ਟੇਬਲ ਵਗੈਰਾ ਖਾਲੀ ਹੈ ਉਪਲੱਬਧ ਹੈ ਜਿਹੜੇ ਆਪਾਂ ਨੂੰ ਮਿਲ ਜਾਣ ਖਾਣੇ ਵਾਸਤੇ ਕਿਉਂਕਿ ਅਸੀਂ ਦਸ ਬਾਰਾਂ ਪਰਿਵਾਰ ਦੇ ਮੈਂਬਰ ਹੈਗੇ ਹਾਂ ਜੀ ਅਤੇ ਆਪਣਾ ਦੂਜਾ ਇਹ ਆ ਕਿ ਆਪਣਾ ਗੱਡੀ ਦੇ ਪਾਰਕਿੰਗ ਵਗੈਰਾ ਦਾ ਵੀ ਤੁਸੀਂ ਸਾਨੂੰ ਦੱਸ ਦਿਓ ਕਿ ਗੱਡੀ ਲਗਾਉਣ ਦੇ ਵਿੱਚ ਵੀ ਕੋਈ ਪ੍ਰੋਬਲਮ ਕ੍ਰੀਏਟ ਨਾ ਹੋਵੇ ਜੀ ਗੱਡੀ ਲਗਾਉਣ ਦੀ ਸਹੂਲਤ ਚਾਹੀਦੀ ਹੈ ਨਾ ਭਾਅ ਜੀ ਗੱਡੀ ਲਾਵਾਂਗੇ ਜੀ ਜੀ ਵੇਟਰ ਵਗੈਰਾ ਹੈ ਕਿ ਖੁਦ ਹੀ ਲੈਣਾ ਪੈਂਦਾ ਜੀ ਖਾਣਾ ਤੁਹਾਡੇ ਕੋਲੋਂ ਹਾਂ ਟੇਬਲ 'ਤੇ ਵੇਟਰ ਲੈ ਕੇ ਆਉਣਗੇ ਖਾਣਾ ਠੀਕ ਹੈ ਬਾਈ ਕੁਆਲਿਟੀ ਵਧੀਆ ਹੋਵੇ ਖਾਣਾ ਜਿਹੜਾ ਦੁਬਾਰਾ ਵੀ ਬੰਦਾ ਤੁਹਾਡੇ ਕੋਲ ਵਾਪਿਸ ਆਈ ਜਾਵੇ ਠੀਕ ਹੈ ਭਾਈ ਮਿਹਰਬਾਨੀ ਜੀ